ਪੰਜਾਬ ਦੇ ਪ੍ਰਤੀ ਲੋਕਾਂ ਵਿੱਚ ਬਹੁਤ ਸਾਰੇ ਗ਼ਲਤ ਫ਼ਹਿਮੀਆਂ ਹਨ ਕੋਈ ਲੋਕ ਬਾਹਰੋਂ ਕਹਿੰਦੇ ਹਨ ਕਿ ਪੰਜਾਬ 'ਚ ਬਹੁਤ ਗੁੰਡਾਗਰਦੀ ਹੈ ਜਿਵੇਂ ਕਿ ਮੈਂ ਤਾਂ ਪੰਜਾਬ ਵਿੱਚ ਰਹਿੰਦੀ ਹਾਂ ਸਾਨੂੰ ਤਾਂ ਅਜਿਹਾ ਕੁਝ ਨਹੀਂ ਲੱਗਦਾ ਕਿ ਇੱਥੇ ਕੋਈ ਗੁੰਡਾਗਰਦੀ ਹੈ ਕੋਈ ਗੁੰਡਾਗਰਦੀ ਨਹੀਂ ਹੈ ਅਤੇ ਜੋ ਕੋਈ ਨਸ਼ੇ ਆ ਨਸ਼ਿਆਂ ਦੇ ਵਿਰੁੱਧ ਸਰਕਾਰ ਵਧੀਆ ਉਪਰਾਲਾ ਕਰ ਰਹੀ ਆ ਘਰ ਘਰ ਜਾ ਕੇ ਲੋਕਾਂ ਨੂੰ ਨਸ਼ਾ ਮੁਕਤ ਕਰ ਰਹੀ ਹੈ ਜੇ ਕੋਈ ਨਸ਼ਾ ਕਰਦਾ ਮਿਲ ਜਾਂਦਾ ਨਸ਼ਾ ਵੇਚਦਾ ਮਿਲ ਜਾਂਦਾ ਹੈ ਤਾਂ ਉਹਨਾਂ ਨੂੰ ਉਸ ਪੁਲਿਸ ਬਹੁਤ ਸਖ਼ਤ ਤੋਂ ਸਖ਼ਤ ਸਜ਼ਾ ਦਿੰਦੀ ਹੈ ਅਤੇ ਬਾਕੀ ਪੋਲਿਊਸ਼ਨ ਕੋਈ ਪੋਲਿਊਸ਼ਨ ਨਹੀਂ ਹੈ ਅਤੇ ਲੋਕਾਂ ਨੂੰ ਨੂੰ ਵਧੀਆ ਇੱਥੇ ਜਾਣ ਨੂੰ ਮਿਲਦਾ ਹੈ ਅਤੇ ਥਾਂ ਥਾਂ ਲਾਈਟਾਂ ਲੱਗੀਆਂ ਹੋਈਆਂ ਕੈਮਰੇ ਲੱਗੇ ਹੋਏ ਹਨ ਅਤੇ ਬਾਕੀ ਮੌਸਮ ਮੌਸਮ ਬਹੁਤ ਵਧੀਆ ਹੈ ਕੋਈ ਗਰਮੀ ਨਹੀਂ ਹੈ ਬਿਲਕੁਲ ਠੀਕ ਹੈ ਮੀਂਹ ਪੈ ਜਾਂਦੇ ਹਨ ਮੌਸਮ ਹਰ ਤਰ੍ਹਾਂ ਦੇ ਬਦਲਦਾ ਰਹਿੰਦਾ ਕਿਤੇ ਗਰਮੀ ਆ ਜਾਂਦੀ ਅਤੇ ਕਿਤੇ ਠੰਡ ਆ ਜਾਂਦੀ ਹੈ ਅਤੇ ਮੈਂ ਪੰਜਾਬ 'ਚ ਰਹਿੰਦੀ ਹਾਂ ਅਤੇ ਮੈਨੂੰ ਬਹੁਤ ਮਾਣ ਹੈ